ਆਧੁਨਿਕ ਸੰਸਾਰ ਦੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਹੀ ਬੋਲਬਾਲਾ ਹੈ ਜੇ ਕੋਈ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਦੇ ਹਨ ਤਾਂ ਇਸ ਦੇ ਵਿੱਚ ਉਹਨਾਂ ਨੂੰ ਆਪਣੀ ਹੀਨਤਾ ਦਾ ਅਹਿਸਾਸ ਹੁੰਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰ ਰਹੇ ਹਨ ਉਹ ਵਿਦਿਆਰਥੀ ਸਾਡੇ ਤੋਂ ਕਿਤੇ ਹੀ ਵਧੀਆ ਹਨ ਅਤੇ ਇੱਕ ਹੁਣ ਵਿਦਿਆਰਥੀਆਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਦੀ ਹੋੜ ਲੱਗੀ ਹੋਈ ਹੈ ਇਸ ਕਰਕੇ ਉਹ ਦੂਜੀਆਂ ਭਾਸ਼ਾਵਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਆਪਣੀ ਮਾਤ ਬੋਲੀ ਪੰਜਾਬੀ ਵੱਲ ਇੰਨਾਂ ਧਿਆਨ ਨਹੀਂ ਦਿੰਦੇ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਜਦੋਂ ਆਪਾਂ ਕੋਈ ਗੱਲਬਾਤ ਕਰਦੇ ਹਾਂ ਤਾਂ ਗੱਲਾਂ ਦੇ ਵਿੱਚ ਮੁਹਾਵਰੇ ਮੁ ਮੁਹਾਵਰੇ ਹੋਰ ਅ ਅਜਿਹੇ ਸ਼ਬਦ ਲੋਕ ਯੂਜ ਕਰਦੇ ਸੀਗੇ ਪਰ ਹੁਣ ਇਹ ਜੋ ਵਿਹਾਰ ਹੈ ਬਿਲਕੁਲ ਹੀ ਘਟਦਾ ਜਾ ਰਿਹਾ ਲੋਕ ਪੰਜਾਬੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਨੂੰ ਬੋਲਣਾ ਜ਼ਿਆਦਾ ਤਵੱਜੋ ਨਾਲ ਜ਼ਿਆਦਾ ਤਵੱਜੋ ਦਿੰਦੇ ਆ ਅੰਗਰੇਜ਼ੀ ਭਾਸ਼ਾ ਨੂੰ ਬੋਲਣ ਦੇ ਵਿੱਚ